ਪੰਜਾਬੀ ਭਾਸ਼ਾ ਸਾਡੇ ਇੱਕ ਰਾਜ ਦੀ ਇੱਕ ਐਸੀ ਭਾਸ਼ਾ ਹੈ ਜਿਹੜੇ ਕਿ ਸਾਨੂੰ ਬੋਲਣ 'ਤੇ ਮਾਨ ਮਹਿਸੂਸ ਹੁੰਦਾ ਹੈ ਪੰਜਾਬੀ ਅੱਜ ਤੋਂ ਅੱਜ ਦੀ ਭਾਸ਼ਾ ਨਹੀਂ ਹੈ ਇਹ ਸਾਡੇ ਗੁਰਮੁਖੀ ਜਿਹੜੇ ਕਿ ਸਾਡੇ ਪੀਰ ਪੈਗੰਬਰ ਸਾਡੇ ਗੁਰੂ ਸਾਹਿਬਾਨ ਸਾਨੂੰ ਵਿਰਾਸਤ ਵਿੱਚ ਇਹ ਦੇ ਕੇ ਗਏ ਹਨ ਪੰਜਾਬੀ ਬੋਲਣ 'ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਅਸੀਂ ਪੰਜਾਬ ਦੇ ਸਾਰੇ ਇੱਥੇ ਵਾਸੀ ਹਾਂ ਕਈ ਲੋਕ ਪੰਜਾਬੀਆਂ ਪੰਜਾਬੀ ਬੋਲਣ 'ਤੇ ਗੁਰੇਜ਼ ਕਰਦੇ ਹਨ ਅਤੇ ਸਾਨੂੰ ਬੜਾ ਆਕਵਰਡ ਫੀਲ ਹੁੰਦਾ ਹੈ ਵੀ ਇਹ ਸਾਰੇ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਮ ਭਾਸ਼ਾ ਨੂੰ ਨਹੀਂ ਬੋਲਦੇ ਹਨ ਅਤੇ ਇਸ ਲਈ ਅਤੇ ਪੰਜਾਬੀ ਭਾਸ਼ਾ ਸਾਡੀ ਸਭ ਤੋਂ ਅੱਗੇ ਰੱਖਣੀ ਚਾਹੀਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਜੇ ਪੰਜਾਬੀ ਸੂਬੇ ਵਿੱਚ ਜਨਮ ਲਿਆ ਹੈ ਤਾਂ ਸਾਨੂੰ ਪੰਜਾਬੀ ਭਾਸ਼ਾ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਿਵੇਂ ਮਾਨ ਸਾਹਿਬ ਨੇ ਜਿਹੜੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਪਿੱਛੇ ਜੇ ਐਲਾਨ ਕੀਤਾ ਸੀ ਵੀ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਦੇ ਉੱਪਰ ਜਿਹੜੇ ਬੋਰਡ ਲੱਗੇ ਹੁੰਦੇ ਆ ਇਹਨਾਂ ਦੀ ਦੁਕਾਨ ਦਾ ਨਾਮ ਜੋ ਹੈ ਉਹ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਵਿੱਚ ਲਿਖਿਆ ਜਾਵੇ ਅਤੇ ਉਸ ਤੋਂ ਥੱਲੇ ਚਾਹੇ ਆਪਣੀ ਜਿਹੜੀ ਵੀ ਮਰਜ਼ੀ ਭਾਸ਼ਾ ਤੁਸੀਂ ਵਰਤ ਸਕਦੇ ਹੋ ਇਹ ਬੜਾ ਹੀ ਚੰਗਾ ਉਪਰਾਲਾ ਹੈ ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਵੀ ਨੀਚੇ ਜਿੰਨੇ ਵੀ ਦੱਖਣੀ ਸ਼ ਆਪਣੇ ਸ਼ਹਿਰ ਹਨ ਜਾਂ ਸਟੇਟਾਂ ਹਨ ਸੂਬੇ ਹਨ ਉਹ ਸਾਰਿਆਂ ਤੋਂ ਉੱਪਰ ਆਪਣੀ ਮਾਤਰ ਭਾਸ਼ਾ ਨੂੰ ਚਾਹੇ ਉਹਨਾਂ ਦੀ ਭਾਸ਼ਾ ਕੰਨੜ ਹੈ ਚਾਹੇ ਉਹਨਾਂ ਦੀ ਭਾਸ਼ਾ ਤੇਲਗੂ ਹੈ ਉਹ ਸਭ ਤੋਂ ਉੱਪਰ ਉਹਨਾਂ ਨੂੰ ਰੱਖਦੇ ਹਨ ਅਤੇ ਜਿੰਨੇ ਵੀ ਤੁਸੀਂ ਦੇਖੋਗੇ ਉੱਥੇ ਬੋਰਡ ਬੱਸਾਂ ਦੇ ਬੋਰਡ ਹੋ ਗਏ ਬੱਸ ਕਿੱਥੇ ਜਾਣੀ ਹੈ ਉਹਨਾਂ ਦੀ ਆਪਣੀ ਮਾਤ ਭਾਸ਼ਾ ਵਿੱਚ ਹੀ ਦੇਖੀ ਅਤੇ ਇਸ ਲਈ ਪੰਜਾਬੀ ਨੂੰ ਵੀ ਉਸਦਾ ਮਾਣ ਹੱਕਦਾਰ ਸ ਭਾਸ਼ਾ ਉਹ ਉਹਨਾਂ ਨੂੰ ਪੰਜਾਬੀ ਭਾਸ਼ਾ ਨੂੰ ਵੀ ਉਹਦਾ ਬਣਦਾ ਹੱਕ ਸਾਨੂੰ ਦੇਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਅਸੀਂ ਪੰਜਾਬੀ ਪੰਜਾਬ 'ਚ ਰਹਿੰਦੇ ਹਾਂ ਪਹਿਲੇ ਨੰਬਰ 'ਤੇ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ